ਤਕਨੋਲੋਜੀ ਸਾਡੇ ਕਾਰੋਬਾਰ ਅਤੇ ਲੈਣ ਦੇਣ ਦੇ ਤਰੀਕੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਦਲ ਰਹੀ ਹੈ ਇਹਦੇ ਆਪਣੇ ਆਪਣੇ ਕੁਛ ਲਾਭ ਵੀ ਹਨ ਅਤੇ ਹਾਨੀਆਂ ਵੀ ਹਨ ਪਹਿਲਾਂ ਦੇਖਿਆ ਜਾਵੇ ਤਾਂ ਅਸੀਂ ਅਕਾਊਂਟਿੰਗ ਸਿਸਟਮ ਵਿੱਚ ਸਾਡਾ ਜਿਹੜਾ ਰਿਕਾਰਡ ਹੁੰਦਾ ਸੀਗਾ ਉਹ ਬਹੀ ਖਾਤਿਆਂ ਵਿੱਚ ਬਣਦਾ ਸੀਗਾ ਜੀ ਜਿਹਦੇ ਵਿੱਚ ਸਾਰਾ ਹੀ ਕੰਮ ਹੱਥ ਲਿਖਤ ਹੁੰਦਾ ਸੀ ਅਤੇ ਸਾਰਾ ਹੀ ਰਿਕਾਰਡ ਜਿਹੜਾ ਸੀਗਾ ਉਹ ਬੁੱਕ ਕੀਪਿੰਗ ਜਿ ਜਿਹਨੂੂੰ ਕਿ ਅਸੀਂ ਬਹੀ ਖਾਤਾ ਕਹਿੰਦੇ ਹਾਂ ਉਹਦੇ ਵਿੱਚ ਦਰਜ ਕੀਤਾ ਜਾਂਦਾ ਸੀ ਅਤੇ ਹੁਣ ਸਮੇਂ ਦੇ ਨਾਲ ਨਾਲ ਕੰਪਿਊਟਰ ਦੇ ਆਉਣ ਦੇ ਨਾਲ ਕਾਫੀ ਤਬਦੀਲੀਆਂ ਆਈਆਂ ਹਨ ਉਹਦੀਆਂ ਆਪਣੀਆਂ ਕੋਈ ਹਾਨੀਆਂ ਸੀ ਜਿਹੜੀਆਂ ਕਿਤਾਬਾਂ ਵਿੱਚ ਕੰਮ ਹੁੰਦੇ ਸੀ ਜੇ ਕੋਈ ਚੀਜ਼ ਗਲਤ ਹੋ ਜਾਂਦੀ ਸੀ ਤਾਂ ਉਹਨੂੰ ਅਸੀਂ ਦੁਬਾਰਾ ਠੀਕ ਨਹੀਂ ਸੀ ਕਰ ਸਕਦੇ ਸਾਨੂੰ ਨਵੇਂ ਸਿਰੇ ਤੋਂ ਹੀ ਦੁਬਾਰਾ ਕੰਮ ਸ਼ੁਰੂ ਕਰਨਾ ਪੈਂਦਾ ਸੀ ਜਿਹੜਾ ਕਿ ਸਮਾਂ ਵੀ ਸਾਡਾ ਜ਼ਿਆਦਾ ਲੈਂਦਾ ਸੀ ਪਰ ਜੇ ਹੁਣ ਦੇਖਿਆ ਜਾਵੇ ਤਾਂ ਕੰਪਿਊਟਰ ਯੁੱਗ ਦੇ ਆਉਣ ਦੇ ਨਾਲ ਨਿੱਤ ਨਵੀਆਂ ਐਪਲੀਕੇਸ਼ਨਸ ਜਿਹੜੀਆਂ ਯੂਜ ਹੁੰਦੀਆਂ ਹਨ ਜਿਵੇਂ ਕਿ ਅਸੀਂ ਅਕਾਊਂਟਿੰਗ ਦੀ ਗੱਲ ਕਰੀਏ ਤਾਂ ਟੈਲੀ ਅਤੇ ਸੈਪ ਵਰਗੇ ਸੋਫਟਵੇਅਰ ਜਿਹੜੇ ਯੂਜ ਹੋ ਰਹੇ ਹਨ ਜਾਂ ਵਰਤੋਂ 'ਚ ਆ ਰਹੇ ਹਨ ਉਹਨਾਂ ਕਰਕੇ ਜਿਹੜੇ ਕੰਮ ਨੇ ਉਹ ਆਸਾਨ ਹੋ ਗਏ ਨੇ ਅਤੇ ਜਿਹੜੇ ਮਹੀਨਿਆਂ ਦੇ ਕੰਮ ਸੀ ਉਹ ਦਿਨਾਂ ਵਿੱਚ ਅਤੇ ਦਿਨਾਂ ਦੇ ਕੰਮ ਘੰਟਿਆਂ ਵਿੱਚ ਅਤੇ ਘੰਟਿਆਂ ਦੇ ਕੰਮ ਜਿਹੜੇ ਹੈਗੇ ਨੇ ਉਹ ਕੁਛ ਸੈਕਿੰਡਾਂ ਵਿੱਚ ਹੀ ਹੋਣ ਲੱਗ ਪਏ ਹਨ ਸੋ ਇਹ ਬਿਲਕੁਲ ਸਹੀ ਕਹਿਣਾ ਹੈ ਕਿ ਜਿਹੜੀ ਤਕਨੋਲਜੀ ਉਹ ਸਾਰੇ ਕਾਰੋਬਾਰ ਅਤੇ ਅਤੇ ਲੈਣ ਦੇਣ ਦੇ ਤਰੀਕੇ ਨੂੰ ਬਹੁਤ ਚੰਗੇ ਤਰੀਕੇ ਨਾਲ ਬਦਲ ਰਹੀ ਹੈ